ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮਿਲ ਜੂਗਾ ਜੀ ਹਾਂਜੀ ਹਾਂਜੀ ਮਿਲ ਜਾਣਗੇ ਜੀ ਹਾਂਜੀ ਮਿਲ ਜਾਣਗੇ ਜੀ ਹਾਂਜੀ ਮਿਲ ਜਾਣਗੀਆਂ ਦਾਲ ਠੀਕ ਹੈ ਜੀ ਓਕੇ ਜੀ ਹਾਂਜੀ ਹਾਂਜੀ ਮਿਲ ਜਾਣਗੇ ਚੌਲ ਬਨਸਪਤੀ ਹੋ ਗਏ ਚੌਲ ਹਾਂਜੀ ਹਾਂਜੀ ਦਾਲ ਮੂੰਗੀ ਮਿਲਦੀ ਹਾਂਜੀ ਮੂੰਗੀ ਮਸਰੀ ਮਿਲਜੂ ਜੀ ਹਰੀ ਮੂੰਗੀ ਹਾਂਜੀ ਹਾਂਜੀ ਚਨੇ ਮਿਲ ਜਾਣਗੇ ਜੀ ਹਾਂਜੀ ਹਾਂਜੀ ਮਿਲ ਜਾਣਗੇ ਚੌਲਾਂ ਦਾ ਜੀ ਜਿਵੇਂ ਬਨਸਪਤੀ 'ਚ ਹਾਂਜੀ ਜਿਵੇਂ ਬਨਸਪਤੀ ਹੈ ਜੀ ਇਹ ਪੰਤਾਲੀ ਕੁ ਰੁਪਈਏ ਕਿਲੋ ਵੀ ਮਿਲ ਜਾਂਦੇ ਆ ਜੀ ਠੀਕ ਆ ਨਾ ਵਧੀਆ ਚੌਲ ਹੁੰਦੇ ਨੇ ਜਿਹੜੇ ਹਾਂਜੀ ਬਾਕੀ ਜਿਹੜੇ ਦੂਜੇ ਚੌਲ ਹੁੰਦੇ ਉਹ ਅੱਡੋ ਅੱਡੀ ਰੇਟ ਹੁੰਦਾ ਜੀ ਉਹਨਾਂ ਦਾ ਹਾਂਜੀ ਹਾਂਜੀ ਹਾਂਜੀ ਮਿਲ ਜੂਗਾ ਜੀ ਮਿਲ ਜੂਗਾ ਜੀ ਮਿਲ ਜੂਗਾ ਹਾਂਜੀ ਹਾਂਜੀ ਮਿਲ ਜਾਣਗੇ ਮਿਲ ਓਕੇ ਜੀ ਹਾਂਜੀ ਹਾਂਜੀ ਆਪਣਾ ਬਰਨਾਲਾ ਚੌਂਕ ਜੀ ਨੂਰ ਮਹਿਲ ਚੌਂਕ ਕੋਲ ਆਪਣੀ ਦੁਕਾਨ ਆ ਜੀ ਕਰਿਆਨਾ ਸਟੋਰ ਹਾਂਜੀ ਹਾਂ ਹਾਂ ਜੀ ਜਮਾਂ ਇਕ ਨੰਬਰ ਮਾਲ ਮਿਲੂਗਾ ਜੀ ਚੌਲ ਹੋ ਗਏ ਠੀਕ ਹੈ ਨਾ ਜੀ ਆਪਣੇ ਕੋਲ ਸਾਰਾ ਸਮਾਨ ਹੀ ਮਿਲਜੂਗਾ ਜੀ ਚੌਲ ਬਨਸਪਤੀ ਚੌਲ ਇੰਡੀਆ ਚੌਲ ਠੀਕ ਹੈ ਨਾ ਜੀ ਅਤੇ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਨਹੀਂ ਤਾਂ ਜੀ ਤੁਹਾਨੂੰ ਉਸੇ ਵੇਲੇ ਅੱਜ ਮਿਲਣੀ ਜਿਹੜੇ ਇੰਡੀਆ ਚੌਲ ਆ ਜੀ ਉਹ ਵੀ ਵਧੀਆ ਨੇ ਜੀ ਆਪਣੇ ਕੋਲ ਤਾਜ਼ੇ ਹੁੰਦੇ ਠੀਕ ਹੈ ਨਾ ਜੀ ਅਤੇ ਜਿਹੜੇ ਖੀਰ ਵਾਲੇ ਚੌਲ ਹੁੰਦੇ ਆ ਜੀ ਇਹ ਵੀ ਵਧੀਆ ਹੁੰਦੇ ਨੇਗੇ ਇਹ ਤੁਹਾਨੂੰ ਕੋਈ ਵੀ ਮੰਨ ਕੇ ਚੱਲ ਵੀ ਪਰੇਸ਼ਾਨੀ ਆਉਂਦੀ ਹੈ ਕਿ ਕਦੋਂ ਵੀ ਤੁਸੀਂ ਵਾਪਿਸ ਕਰ ਸਕਦੇ ਹੈਗੇ ਹਾਂਜੀ ਹਾਂਜੀ ਹਾਂਜੀ ਮਿਲ ਜਾਣਗੇ ਜੀ ਮਿਲ ਜਾਣਗੇ ਹਾਂਜੀ ਤੁਹਾਨੂੰ ਸਾਰਾ ਸਮਾਨ ਹੀ ਆਪਣੇ ਕੋਲੋਂ ਦੇ ਦਾਂਗੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰਾ ਕੁਛ ਹਾਂਜੀ ਦਾਲਾਂ ਦਾ ਰੇਟ ਵੀ ਦੱਸ ਦਾਂਗੇ ਹਰਾ ਹਰੀ ਦਾਲ ਹੋਗੀ ਜਿਵੇਂ ਮੂੰਗੀ ਦਾਲ ਹੋਗੀ ਚਨੇ ਹੋ ਗਏ ਜੀ ਠੀਕ ਹੈ ਨਾ ਜੀ ਮੂੰਗੀ ਮਸਰੀ ਹੋ ਗਈ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਆ ਜਾਇਓ ਜੀ ਜਦੋਂ ਮਰਜ਼ੀ ਠੀਕ ਹੈ ਨਾ ਜੀ ਹਾਂਜੀ ਰੇਟ ਦੀ ਗੱਲ ਆਪਾਂ ਬਹਿ ਕੇ ਕਰ ਲਾਂਗੇ ਜੀ ਹਾਂਜੀ ਹਾਂਜੀ